ਅਸੀਂ ਜਦੋਂ ਪੰਛੀਆਂ ਨੂੰ ਦੇ ਦੇਖਦੇ ਹਾਂ ਤਾਂ ਸਾਨੂੰ ਬਹੁਤ ਵਧੀਆ ਲੱਗਦਾ ਹੈ ਇਹ ਅਸਮਾਨ ਵਿੱਚ ਉੱਡਦੇ ਬਹੁਤ ਵਧੀਆ ਲੱਗਦੇ ਹਨ ਜਦੋਂ ਅਸੀਂ ਚਿੜੀਆਘਰ ਵਿੱਚ ਜਾਂਦੇ ਹਾਂ ਤਾਂ ਅਸੀਂ ਉੱਥੇ ਬਹੁਤ ਸਾਰੇ ਪੰਛੀ ਦੇਖਣ ਨੂੰ ਮਿਲਦੇ ਹੈ ਕਈ ਅਸੀਂ ਕਦੇ ਅਸੀਂ ਦੇਖੇ ਵੀ ਨਹੀਂ ਜਿਵੇਂ ਜਿਵੇਂ ਕਿ ਹਾਥੀ ਜਿਰਾਫ਼ ਸ਼ੇਰ ਆਦਿ ਹੋਰ ਤਰ੍ਹਾਂ ਦੇ ਵੀ ਜਾਨਵਰ ਹੁੰਦੇ ਹਨ ਮੈਂ ਕਹਿਣਾ ਚਾਹੁੰਦਾ ਹਾਂ ਕਿ ਸਾਨੂੰ ਵੱਧ ਤੋਂ ਵੱਧ ਜਾਨਵਰਾਂ ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ ਸਾਨੂੰ ਵੱਧ ਤੋਂ ਵੱਧ ਚਿੜੀਆਘਰ ਵਿੱਚ ਜਾਣਾ ਚਾਹੀਦਾ ਹੈ